ਸਾਡੇ ਇਲਾਕੇ ਦੇ ਐਮਐਲਏ ਰਮਨ ਨੇ ਮੇਰੀ ਅੱਜ ਤੱਕ ਉਹਨਾਂ ਨਾਲ ਕੋਈ ਗੱਲਬਾਤ ਤਾਂ ਨਹੀਂ ਹੋਈ ਪਰ ਉਹਨਾਂ ਦੁਆਰਾ ਕੀਤੇ ਕੰਮ ਸਾਨੂੰ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਉਨਾਂ ਨੇ ਜਿਹੜੀਆਂ ਟੁੱਟ ਗਈਆਂ ਸੜਕਾਂ ਨੇ ਉਹਨਾਂ ਨੂੰ ਸਹੀ ਕਰਵਾਇਆ ਜਿਸ ਕਰਕੇ ਜਨਤਾ ਬਹੁਤ ਪਰੇਸ਼ਾਨ ਸੀ ਜਗ੍ਹਾ ਜਗ੍ਹਾ ਤੇ ਟੋਏ ਸੀ ਉਹਨਾਂ ਨੇ ਉਹ ਵੀ ਠੀਕ ਕਰਵਾਏ ਜਿਸ ਨਾਲ ਆਮ ਜਨਤਾ ਨੂੰ ਬਹੁਤ ਰਾਹਤ ਮਿਲੀ ਫਿਰ ਉਹਨਾਂ ਨੇ ਗਲੀ ਵਿੱਚ ਲੱਗੀਆਂ ਲਾਈਟਾਂ ਨੂੰ ਵੀ ਠੀਕ ਕਰਵਾਇਆ ਅਤੇ ਜਿੱਥੇ ਜਿੱਥੇ ਲਾਈਟਾਂ ਦੀ ਜਰੂਰਤ ਸੀ ਉਥੇ ਉਥੇ ਨਵੀਂ ਲਾਈਟਾਂ ਵੀ ਲਗਾਈਆਂ ਇਸ ਨਾਲ ਵੀ ਆਮ ਜਨਤਾ ਨੂੰ ਬਹੁਤ ਰਾਹਤ ਮਿਲੀ ਫਿਰ ਉਹਨਾਂ ਨੇ ਸਾਫ ਸਫਾਈ ਵੱਲ ਵੀ ਬਹੁਤ ਧਿਆਨ ਦਿੱਤਾ ਸਾਫ ਸਫਾਈ ਹਰ ਮਹੱਲੇ ਚ ਹੋਣੀ ਬਹੁਤ ਜਰੂਰੀ ਹੈ ਕਿਉਂਕਿ ਇਸ ਨਾਲ ਹੀ ਬਿਮਾਰੀਆਂ ਫੈਲਦੀਆਂ ਨੇ ਅਤੇ ਇਸ ਨੂੰ ਬਚਾਅ ਕਰਨ ਲਈ ਉਹਨਾਂ ਨੇ ਸਾਫ ਸਫਾਈ ਦਾ ਕਾਫੀ ਧਿਆਨ ਦਿੱਤਾ ਜਗ੍ਹਾ ਜਗ੍ਹਾ ਕੂੜੇ ਦੇ ਢੇਰਾਂ ਨੂੰ ਉਹਨਾਂ ਨੇ ਖਤਮ ਕਰਵਾਇਆ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਇੱਕ ਸਮੱਸਿਆ ਹੋਰ ਜਿਹੜੀ ਆਂਦੀ ਹੈ ਉਹ ਹੈ ਪਾਣੀ ਤੇ ਸੀਵਰੇਜ ਦੀ ਸਮੱਸਿਆ ਉਨਾਂ ਨੇ ਇਸ ਵੱਲ ਵੀ ਬਹੁਤ ਕੰਮ ਕੀਤਾ ਅਤੇ ਲੋਕਾਂ ਦੀਆਂ ਪਰੇਸ਼ਾਨੀ ਨੂੰ ਖਤਮ ਕਰਨ ਲਈ ਮਹੱਲੇ ਮਹੱਲੇ ਵਿੱਚ ਘੁੰਮੇ ਅਤੇ ਲੋਕਾਂ ਦੀ ਪਰੇਸ਼ਾਨੀ ਸੁਣੀਆਂ ਉਸ ਤੇ ਕਾਫੀ ਉਹਨਾਂ ਨੇ ਕੰਮ ਕੀਤਾ ਉਹਨਾਂ ਦੀ ਕੋਸ਼ਿਸ਼ ਇਹੀ ਸੀ ਕਿ ਵੱਧ ਤੋਂ ਵੱਧ ਜਨਤਾ ਨੂੰ ਆਰਾਮ ਦਿੱਤਾ ਜਾਏ ਕਿਉਂਕਿ ਉਹਨਾਂ ਨੇ ਸਾਨੂੰ ਚੁਣਿਆ ਹੈ ਤੇ ਅਸੀਂ ਉਹਨਾਂ ਦੀ ਹੀ ਫਾਇਦੇ ਲਈ ਕੰਮ ਕਰੀਏ